ਭੰਗੜਾ ਪੰਜਾਬ ਦਾ ਮੁੱਖ ਨਾਚ ਹੈ ਇਸ ਕਰਕੇ ਭੰਗੜਾ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਹੁਣ ਰੱਖਿਆ ਜਾਂਦਾ ਹੈ ਇਸ ਕਰਕੇ ਭੰਗੜਾ ਵਿਆਹ ਸ਼ਾਦੀ ਦਾ ਵੀ ਪਾਇਆ ਜਾਂਦਾ ਹੈ ਉਹ ਹੋਲੀ ਲੋਹੜੀ ਮੇਲਿਆਂ 'ਤੇ ਵੀ ਬਹੁਤ ਭੰਗੜਾ ਪਾਇਆ ਜਾਂਦਾ ਹੈ ਜਿਵੇਂ ਕਿ ਭੰਗੜੇ ਵਿੱਚ ਰੌਣਕ ਮੇਲਾ ਬਹੁਤ ਜ਼ਿਆਦਾ ਹੁੰਦਾ ਹੈ ਚਾਦਰੇ ਕੁੜਤੇ ਪਾਏ ਜਾਂਦੇ ਹਨ ਪੁਸ਼ਾਕਾਂ ਵੀ ਤਰ੍ਹਾਂ ਤਰ੍ਹਾਂ ਦੀਆਂ ਪਾਈਆਂ ਜਾਂਦੀਆਂ ਹਨ ਝੂੰਮਰ ਵੀ ਵਿੱਚ ਲਾਏ ਜਾਂਦੇ ਹਨ ਇਸ ਕਰਕੇ ਲੋਕ ਦੇਖਣ ਵਾਲੇ ਵੀ ਭੰਗੜਾ ਪਾਉਣ ਨੂੰ ਦੂਸਰਿਆਂ ਦਾ ਵੀ ਬਹੁਤ ਮਨ ਕਰਦਾ ਹੈ ਉਹ ਵੀ ਨਾਲ ਲੱਗ ਜਾਂਦੇ ਹਨ ਭੰਗੜਾ ਪਾਉਣ ਵਾਲੀ ਭੰਗੜਾ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਰੱਖਿਆ ਬਹੁਤ ਹੀ ਜ਼ਿਆਦਾ ਹੈ ਇਸ ਕਰਕੇ ਪੰਜਾਬ ਵਿੱਚ ਭੰਗੜਾ ਜ਼ਿਆਦਾ ਹੀ ਮੇਲਿਆਂ ਲੋਹੜੀਆਂ ਹੋਲੀਆਂ ਦਿਵਾਲੀਆਂ ਵਿੱਚ ਭੰਗੜਾ ਪਾਇਆ ਜਾਂਦਾ ਹੈ ਨੋਕ ਵਾਲੀ ਜੁੱਤੀ ਚਾਦਰੇ ਕੁੜਤੇ ਪੱਗਾਂ ਪੋਚਵੀਆਂ ਬੰਨ ਕੇ ਭੰਗੜਾ ਪਾਉਂਦੇ ਹਨ ਇਸ ਕਰਕੇ ਭੰਗੜੇ ਦਾ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਹੈ ਇਸ ਕਰਕੇ ਪੁਸ਼ਾਕ ਪੁਸ਼ਾਕਾਂ ਵੀ ਬਹੁਤ ਪੀਲੀਆਂ ਨੀਲੀਆਂ ਹਰੀਆਂ ਪਾਉਂਦੇ ਹਨ ਇਸ ਕਰਕੇ ਮੁੰਡੇ ਬਹੁਤ ਜ਼ਿਆਦਾ ਭੰਗੜੇ ਪਾਉਂਦੇ ਹਨ ਇੱਕ ਦੂਸਰੇ ਨੂੰ ਦੇਖ ਕੇ ਭੰਗੜਾ ਦੂਸਰਿਆਂ ਦਾ ਵੀ ਮਨ ਕਰਦਾ ਭੰਗੜਾ ਪਾਉਣ ਨੂੰ ਭੰਗੜਾ ਪੰਜਾਬ ਵਿੱਚ ਪਹਿਲੀ ਸਥਿਤ ਹੈ ਇਸ ਕਰਕੇ ਭੰਗੜਾ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਭੰਗੜਾ ਹਰ ਇੱਕ ਹਰ ਇੱਕ ਹਰ ਇੱਕ ਤਿਉਹਾਰ 'ਤੇ ਭੰਗੜੇ ਦਾ ਹੀ ਜ਼ਿਆਦਾ ਯੋਗਦਾਨ ਹੈ ਇਸ ਕਰਕੇ ਭੰਗੜਾ ਪੰਜਾਬ ਵਿੱਚ ਪਹਿਲੇ ਨੰਬਰ 'ਤੇ ਹੈ ਭੰਗੜਾ ਹਰ ਇੱਕ ਜਗ੍ਹਾ 'ਤੇ ਭੰਗੜਾ ਵਿਆਹ ਸ਼ਾਦੀ ਲੋਹੜੀ ਹੋਲੀ ਦਿਵਾਲੀ ਪਾਇਆ ਜਾਂਦਾ ਹੈ